ਮੈਂ ਸਿੱਖ ਧਰਮ ਨਾਲ ਸੰਬੰਧ ਰੱਖਦਾ ਹਾਂ ਜਿਸ ਕਰਕੇ ਮੈਂ ਹਰੇਕ ਮਹੀਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕਰਨ ਜਾਂਦਾ ਹਾਂ ਜੋ ਕਿ ਮੇਰੇ ਮਨ ਨੂੰ ਬਹੁਤ ਹੀ ਸਕੂਨ ਪਹੁੰਚਾਉਂਦੀ ਹੈ ਇਸ ਕਰਕੇ ਮੇਰੇ ਲਈ ਸਭ ਤੋਂ ਵੱਧ ਦਿਲਚਸਪ ਜਗ੍ਹਾ ਹਰਿਮੰਦਰ ਸਾਹਿਬ ਹੈ ਜਿੱਥੇ ਕਿ ਅਸੀਂ ਮੱਥਾ ਟੇਕਦੇ ਹਾਂ ਅਤੇ ਬਾਅਦ ਵਿੱਚ ਨੇੜੇ ਤੇੜੇ ਸ਼ਹਿਰ ਵਿੱਚ ਵੀ ਘੁੰਮਦੇ ਹਾਂ ਜਲ੍ਹਿਆਂਵਾਲਾ ਬਾਗ ਵੀ ਅਸੀਂ ਜਾਂਦੇ ਹਨ ਅਤੇ ਉੱਥੇ ਆਪਣੇ ਸ਼ਹੀਦ ਭਾਈਆਂ ਦੀ ਯਾਦ ਵਿੱਚ ਵੀ ਡੁੱਬ ਜਾਂਦੇ ਹਾਂ ਵਾਹਗਾ ਬੋਰਡਰ ਵੀ ਨੇੜੇ ਹੀ ਹੈ ਜਿੱਥੇ ਕਿ ਅਸੀਂ ਘੁੰਮਣ ਜਾ ਸਕਦੇ ਹਾਂ ਅਤੇ ਸ਼ਾਮ ਨੂੰ ਬਹੁਤ ਹੀ ਅਲੌਕਿਕ ਪਰੇਡ ਹੁੰਦੀ ਹੈ ਜੋ ਕਿ ਹਰੇਕ ਸੈਲਾਨੀ ਦਾ ਮਨ ਪ੍ਰਸੰਨ ਕਰ ਦਿੰਦੀ ਹੈ